ਜੇ ਮੈਂ ਹਰ ਰੋਜ਼ ਦੀ ਗੱਲ ਕਰਾਂ ਤਾਂ ਸੋਸ਼ਲ ਮੀਡੀਆ ਪਲੈਟਫਾਰਮ ਮੈਂ ਜਿਵੇਂ ਕਿ ਯੂਟੀਊਬ ਵਟਸਐਪ ਸਨੈਪਚੈਟ ਇੰਸਟਾਗਰਾਮ ਇਹਨਾਂ ਸਾਰਿਆਂ ਦੀ ਵਰਤੋਂ ਕਰਦਾ ਹਾਂ ਅਤੇ ਇਹਨਾਂ ਸਾਰਿਆਂ ਨੂੰ ਆਲਮੋਸਟ ਮੈਂ ਰੋਜ਼ ਚਲਾਉਂਦਾ ਅਤੇ ਜਦ ਮੈਂ ਪਰ ਇੰਨਾ ਸਮਾਂ ਨਹੀਂ ਦਿੰਦਾ ਸੋਸ਼ਲ ਮੀਡੀਆ ਐਪਸ ਦੇ ਉੱਤੇ ਬਾਕੀ ਅਗਰ ਇਹਨਾਂ ਦੇ ਵੱਲੋਂ ਆਪਾਂ ਦੇਖਿਆ ਜਾਵੇ ਦ੍ਰਿਸ਼ਟੀਕੋਣ ਜਿਹੜਾ ਕੀ ਪ੍ਰਭਾਵਿਤ ਹੋਏ ਜੇ ਇਹਨਾਂ ਕਰਕੇ ਮੈਂ ਤਾਂ ਉਹ ਹੈ ਕਿ ਇਹ ਐਪਾਂ ਤੋਂ ਆਪਾਂ ਆਲੇ ਦੁਆਲੇ ਦੀ ਜਾਣਕਾਰੀ ਰੱਖ ਸਕਦੇ ਹਾਂ ਪੂਰੇ ਵਿਸ਼ਵ ਦੀ ਜਾਣਕਾਰੀ ਰੱਖ ਸਕਦੇ ਹਾਂ ਬਾਕੀ ਆਪਣੇ ਚਾਹੁੰਦੇ ਹੋਏ ਲੋਕਾਂ ਨੂੰ ਵੀ ਉਹਨਾਂ ਨਾਲ ਸੰਪਰਕ ਵਿੱਚ ਰਹਿ ਸਕਦੇ ਹਨ ਆਪਣੇ ਘਰਦਿਆਂ ਤੋਂ ਜੇ ਕਦੇ ਦੂਰ ਹੋਈਏ ਤਾਂ ਉਹਨਾਂ ਨਾਲ ਵੀ ਆਪਾਂ ਨਜ਼ਦੀਕੀਆਂ ਇਹਦੇ ਨਾਲ ਬਣਾਏ ਰੱਖ ਸਕਦੇ ਹਾਂ ਬਾਕੀ ਇਹਨਾਂ ਦਾ ਕਾਫੀ ਮਹੱਤਵਪੂਰਣ ਅੱਜ ਕੱਲ੍ਹ ਹਰੇਕ ਦੀ ਜ਼ਿੰਦਗੀ ਦੇ ਵਿੱਚ ਅਤੇ ਹਰ ਕੋਈ ਇਹਨਾਂ ਨੂੰ ਵਰਤਦਾ ਹੈ ਅਤੇ ਅੱਜ ਦੇ ਜ਼ਮਾਨੇ ਦੀ ਇਹ ਤਾਂ ਇੱਕ ਲੋੜ ਹਨ ਇਸ ਤੋਂ ਬਿਨਾਂ ਕੰਮ ਕਰਨਾ ਤਾਂ ਔਖਾ ਹੋਊਗਾ ਸਾਰਿਆਂ ਨੂੰ ਠੀਕ ਹੈ ਜੀ